ਸਾਨੂੰ ਕੱਪੜੇ ਦੀਆਂ ਬਹੁਤ ਸਾਰੀਆਂ ਸਮੱਗਰੀਆਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਸਲਵਾਰ ਕਮੀਜ਼ ਹੋ ਗਏ ਘੱਗਰੇ ਹੋ ਗਏ ਅਤੇ ਉਹਨਾਂ ਦੇ ਨਾਲ਼ ਗਹਿਣੇ ਗਹਿਣਿਆਂ ਦੇ ਵਿੱਚ ਆ ਜਾਂਦੇ ਨੇ ਸੱਗੀ ਫੁੱਲ ਪਰਾਂਦੇ ਚੂੜੀਆਂ ਟਿੱਕਾ ਅਤੇ ਹੋਰ ਵੀ ਬਹੁਤ ਸਾਰੇ ਗਹਿਣੇ ਨੇ ਜੋ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਨੇ